ਅੱਛਾ ਜੀ ਇੱਥੇ ਲਾਗੇ ਹਾਂ ਬ ਬ ਵਾਘਾ ਬਾਡਰ ਲੈ ਚੱਲਾਂਗੇ ਤੁਹਾਨੂੰ ਵਾਘਾ ਬਾਡਰ ਦਿਖਾ ਦਿਆਂਗੇ ਹਾਂ ਲਾ ਹਾਂ ਲਾਗੇ ਹੀ ਲਾਗੇ ਹਾਂ ਉਹ ਉਹ ਐਂ ਐਂਟਰੀ ਟਾਈਮ ਹੈਗਾ ਤਿੰਨ ਤੋਂ ਪੰਜ ਅਤੇ ਜਿੰਨਾ ਜਲਦੀ ਪੁੱਜ ਜਾਓ ਓਨਾ ਹੀ ਜਲਦੀ ਬੰਦਾ ਫ੍ਰੀ ਹੋ ਜਾਂਦਾ ਨਹੀਂ ਅੱਧਾ ਕੁ ਘੰਟਾ ਲੱਗ ਹੀ ਜਾਣਾ ਅੱਧਾ ਘੰਟਾ ਲੱਗ ਹੀ ਜਾਣਾ ਘੱਟੋ ਘੱਟ

ਹਾਂ ਆਹ ਲਾਗੇ ਤਾਂ ਹਾਲ ਲੋਕਲ ਲਾਗੇ ਮਾਰਕੀਟ ਵਿੱਚ ਨਾ ਅਤੇ ਇੱਕ ਤਾਂ ਤੁਸੀਂ ਇੱਥੇ ਹਾਲ ਬਜ਼ਾਰ ਘੁੰਮ ਲਓ ਉਹ ਵੀ ਵਧੀਆ ਹੈਗੀ ਦੇਖਣ ਵਾਲੀ ਜਗ੍ਹਾ ਅਤੇ ਮਾਰਕੀਟ ਦੇਖ ਲਉ ਬਾਕੀ ਜਲ੍ਹਿਆਂਵਾਲਾ ਬਾਗ ਦੇਖ ਲਉ ਦਰਬਾਰ ਸਾਹਿਬ ਦੇ ਨਾਲ ਹੀ ਉਹ ਤੁਹਾਡੇ ਦੋ ਘੰਟੇ ਪਾਸ ਹੋ ਜਾਣੇ ਆ ਮਤਲਵ ਕਿ ਡ ਡੇਢ ਕੁ ਢਾਈ ਕੁ ਵਜੇ ਚਲ ਪਾਂਗੇ ਇੱਥੋਂ ਵਾਘਾ ਬਾਡਰ ਵਾਸਤੇ ਅੱਧਾ ਘੰਟਾ ਲੱਗ ਜਾਣਾ ਤਿੰਨ ਕੁ ਵਜੇ ਉੱਥੇ ਹਾਂ ਹਾਂ ਹਾਂ ਦੇਖਣਾ ਚਾਹੀਦਾ ਹੁਣ ਤੁਸੀਂ ਆਏ ਵੇ ਜੇ ਅੰਮ੍ਰਿਤਸਰ ਅਤੇ ਫਿਰ ਵਾਘਾ ਬਾਡਰ ਦੇਖ ਲਉ ਤੁਸੀਂ ਹਾਂ ਹਾਂ ਠੀਕ ਹੈ ਜੀ ਠੀਕ